ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਰੀਆਂ ਕਿਤਾਬਾਂ ਹੀ ਸੋਚ ਉਕਸਾਉਣ ਵਾਲੀਆਂ ਹਨ ਹਰ ਕਿਤਾਬ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ ਅਤੇ ਉਸਦਾ ਦੂਸਰਾ ਪੱਖ ਵੀ ਹੁੰਦਾ ਹੈ ਜਿਸ ਨੂੰ ਕਿ ਅਸੀਂ ਔਗੁਣ ਵੀ ਕਹਿੰਦੇ ਹਾਂ ਕਿਤਾਬਾਂ ਪੜ੍ਹਨ ਪੜ੍ਹ ਕੇ ਵਿਚਾਰ ਪੇਸ਼ ਕਰਨਾ ਬਹੁਤ ਆਸਾਨ ਗੱਲ ਹੈ ਕਈ ਕਿਤਾਬਾਂ ਪੜ੍ਹ ਕੇ ਇੱਕੋਦਮ ਮਨ ਵਿੱਚ ਵਧੀਆ ਵਿਚਾਰ ਆਉਂਦੇ ਹਨ ਮੈਂ ਕਿਸੇ ਵੀ ਰੀਡਿੰਗ ਕਲੱਬ ਦੀ ਮੈਂਬਰ ਨਹੀਂ ਰਹੀ ਮੈਨੂੰ ਟੀਵੀ ਦੇਖਣ ਦਾ ਵੀ ਸ਼ੌਂਕ ਹੈ ਮੈਨੂੰ ਖਬਰਾਂ ਦੇਖਣ ਦਾ ਵੀ ਸ਼ੌਂਕ ਹੈ